ਹੈਲੋ ਗੁਡ ਆਫਟਰਨੂਨ ਸਰ ਸਰ ਮੈਂ ਮਾਲਤੀ ਬੋਲਦੀ ਪਈ ਹਾਂ ਮੈਂ ਤੁਹਾਡੇ ਇੱਕ ਔ ਪੀਜ਼ਾ ਆਰਡਰ ਕੀਤਾ ਸੀ ਫੋਰਮ ਹਾਊਸ ਲਾਰਜ ਸਾਈਜ਼ ਪੀਜ਼ਾ ਸੀਗਾ ਜੋ ਕਿ ਮੈਂ ਤੁਹਾਡੇ ਐਪ ਤੋਂ ਆਰਡਰ ਕਰਿਆ ਹੋਇਆ ਸੀਗਾ ਇਹਦੇ ਨਾਲ ਹੀ ਕੋਲਡ ਡਰਿੰਕ ਸੀਗੀ ਔਰ ਇੱਕ ਕੋ ਕੋਲਡ ਕੌਫੀ ਵੀ ਸੀਗੀ ਉਹਦੇ ਨਾਲ ਇੱਕ ਪਾਸਤਾ ਵੀ ਸੀਗਾ ਜੋ ਕਿ ਮੈਂ ਕਾਫੀ ਕੁਝ ਆਰਡਰ ਕਰਿਆ ਔਰ ਮੇਰਾ ਜੋ ਡੇਲੀਵਰੀ ਟਾਈਮ ਸੀਗਾ ਉਹ ਹਾਫ ਆਰ ਦਾ ਸੀਗਾ ਉਹ ਹੁਣ ਹਾਫ ਆਰ ਤੋਂ ਦਸ ਮਿੰਟ ਉੱਪਰ ਹੋ ਚੁੱਕਿਆ ਔਰ ਡੇਲੀਵਰੀ ਦੀ ਕੋਈ ਵੀ ਸਟੇਟਸ ਮੈਨੂੰ ਸ਼ੋ ਨਹੀਂ ਹੋ ਰਿਹਾ ਸੋ ਪਲੀਜ਼ ਟਰਾਈ ਕਰੋ ਇਹਨੂੰ ਜਲਦੀ ਤੋਂ ਜਲਦੀ ਆਰਡਰ ਕਰੀਏ ਤਾਂ ਜਿਹੜਾ ਮੇਰੇ ਤੱਕ ਪਹੁੰਚ ਜਾਵੇ ਕਿਉਂਕਿ ਇਹ ਇਸ ਤਰਾਂ ਫਿਰ ਲੇਟ ਹੋਣਾ ਸਹੀ ਨਹੀਂ ਲੱਗਦਾ ਹੈਗਾ ਸਾਨੂੰ ਵੀ ਔਖਾ ਹੁੰਦਾ ਤੁਹਾਨੂੰ ਵੀ ਔਖਾ ਹੁੰਦਾ ਅਦਰਵਾਈਜ ਮੈਂ ਅਗਰ ਡੇਲੀਵਰੀ ਟਾਈਮ ਲੇਟ ਹੋਇਆ ਤਾਂ ਮੈਂ ਇਹਨੂੰ ਇੱਥੋਂ ਕੈਂਸਲ ਕਰਕੇ ਦੁਬਾਰਾ ਰੀਔਡਰ ਕਰ ਰਹੀ ਹਾਂ ਕਿਸੇ ਹੋਰ ਕੰਪਨੀ ਤੋਂ ਜਾਂ ਕਿਸੇ ਹੋਰ ਰੈਸਟੋਰੈਂਟ ਤੋਂ ਸੋ ਪਲੀਜ਼ ਟਰਾਈ ਕਰੋ ਕਿ ਵਿਦਇਨ ਫਾਈਵ ਮਿਨਟਸ ਮੇਰਾ ਔਡਰ ਮੈਨੂੰ ਮਿਲ ਜਾਵੇ ਤਾਂ ਕਿ ਫਿਰ ਮੈਂ ਅੱਗੋਂ ਵੀ ਆਪਾਂ ਇਹਨੂੰ ਤੁਹਾਡਾ ਜਿਹੜਾ ਰੈਸਟੋਰੈਂਟ ਇਹਨੂੰ ਰੀ ਵਧੀਆ ਯੂਜ ਕਰ ਸਕੀਏ ਔਰ ਆਪਾਂ ਨੂੰ ਵਧੀਆ ਰੇਟ ਕਰ ਸਕੀਏ ਤੁਹਾਡੇ ਤੁਹਾਡੇ ਰੈਸਟੋਰੈਂਟ ਨੂੰ ਇਸ ਤੋਂ ਇਲਾਵਾ ਸਰ ਅਗਰ ਤੁਸੀਂ ਖਾਣੇ ਵਿੱਚ ਕਟਲਰੀ ਜਿਹੜੀ ਉਹ ਜ਼ਰੂਰ ਐਕਸਟਰਾ ਐਡ ਕਰਿਓ ਪੀਜ਼ਾ ਦੇ ਵਿੱਚ ਤੁਸੀਂ ਸਾਨੂੰ ਸੌ ਕੈਚਅਪ ਔਰ ਔਰੀਕੈਨੋ ਐਕਸਟਰਾ ਦਿਓ ਕਿਉਂਕਿ ਕਿਉਂਕਿ ਤੁਹਾਡੇ ਪੀਜ਼ਾ ਦੇ ਵਿੱਚ ਪਹਿਲਾਂ ਵੀ ਜਿਹੜੀ ਵੀ ਸਾਨੂੰ ਔਰੀਕੈਨੋ ਮਿਲਦਾ ਬਹੁਤ ਘੱਟ ਹੁੰਦਾ ਇਸ ਕਰਕੇ ਜਲ ਜ਼ਿਆਦਾ ਜ਼ਿਆਦਾ ਉਹਨੂੰ ਐਡ ਕਰ ਦਿਓ ਔਰ ਕੋਲਡ੍ਰਿੰਕ ਦਾ ਵੀ ਟਰਾਈ ਕਰਿਓ ਕਿ ਉਹ ਠੰਡੀ ਹੋਵੇ ਗਰਮ ਨਾ ਹੋਵੇ ਕਿਉਂਕਿ ਗਰਮ ਤਾਂ ਪੀ ਨਹੀਂ ਹੁੰਦੀ ਹੈਗੀ ਆ ਓਕੇ ਥੈਂਕਯੂ ਸਰ